ਅੱਠ ਜੂਨ ਦੋ ਹਜ਼ਾਰ ਚੌਵੀ ਦੋ ਸਪਤੰਬਰ ਉੱਨੀ ਸੌ ਸਤਾਨਵੇਂ ਛੇ ਜੂਨ ਉੱਨੀ ਸੌ ਅਠਾਨਵੇਂ ਪੰਜ ਜੂਨ ਉੱਨੀ ਸੌ ਬਾਨਵੇਂ ਪੰਜ ਜਨਵਰੀ ਉੱਨੀ ਸੌ ਇਕਾਨਵੇਂ